ਸਰੀਰਿਕ ਤੌਰ 'ਤੇ ਕਮਜ਼ੋਰ ਵਿਦਿਆਰਥੀ ਜਿਵੇਂ ਕੋਈ ਆਰਥਿਕ ਤੌਰ 'ਤੇ ਕਮਜ਼ੋਰ ਹੈ ਜਾਂ ਜਿਨ੍ਹਾਂ ਦੇ ਸਰੀਰ ਦਾ ਕੋਈ ਅੰਗ ਕੱਟਿਆ ਹੋਇਆ ਹੈ ਜਾਂ ਸਰੀਰ ਦਾ ਕੋਈ ਅੰਗ ਪੂਰਾ ਕੰਮ ਨਹੀਂ ਕਰਦਾ ਅੰਨੇ ਬੋਲੇ ਲੰਗੜੇ ਲੂਲੇ ਲੰਗੜੇ ਇਹਨਾਂ ਦੇ ਵਿਦਿਆਰਥੀਆਂ ਦੇ ਲਈ ਜੋ ਇਹਨਾਂ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਿੱਖਿਆ ਪ੍ਰਣਾਲੀ ਦੇ ਵਿੱਚ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਕੂਲਾਂ ਦੇ ਵਿੱਚ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਜੋ ਵਿਦਿਆਰਥੀ ਸਰੀਰਿਕ ਤੌਰ 'ਤੇ ਕਮਜ਼ੋਰ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੋ ਆਰਥਿਕ ਤੌਰ 'ਤੇ ਕਮਜ਼ੋਰ ਨੇ ਉਹਨਾਂ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵਰਦੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਲੋੜਾਂ ਲਈ ਉਹਨਾਂ ਨੂੰ ਕਿਤਾਬਾਂ ਉਹਨਾਂ ਦੀਆਂ ਕਾਪੀਆਂ ਉਹਨਾਂ ਨੂੰ ਮੁਫ਼ਤ ਵਿੱਚ ਦਿੱਤੀਆਂ ਜਾਂਦੀਆਂ ਨੇ ਅਤੇ ਉਹਨਾਂ ਦੀ ਪੜ੍ਹਾਈ ਦੀ ਜੋ ਸਾਰੀ ਫੀਸ ਹੈ ਉਹ ਵੀ ਸਾਰੀ ਦੀ ਸਾਰੀ ਮਾਫ਼ ਕੀਤੀ ਜਾਂਦੀ ਹੈ ਜੋ ਵਿਸ਼ੇਸ਼ ਤੌਰ 'ਤੇ ਅਪਾਹਜ ਬੱਚੇ ਨੇ ਜਿਨ੍ਹਾਂ ਦੇ ਸਰੀਰ ਦਾ ਕੋਈ ਅੰਗ ਕੱਟਿਆ ਹੋਇਆ ਹੈ ਜਾਂ ਜਿਨ੍ਹਾਂ ਨੂੰ ਸੁਣਦਾ ਨਹੀਂ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਜਾਂ ਬੋਲ ਨਹੀਂ ਸਕਦੇ ਚੰਗੀ ਤਰ੍ਹਾਂ ਅਜਿਹੇ ਵਿਦਿਆਰਥੀਆਂ ਦੇ ਲਈ ਸਕੂਲ ਵੱਖਰੇ ਖੋਲ੍ਹੇ ਗਏ ਹਨ ਜਿਨ੍ਹਾਂ ਦੇ ਵਿੱਚ ਅਜਿਹੇ ਵਿਸ਼ਿਆਂ ਦੇ ਜਿਹੜੇ ਮਾਹਰ ਟ੍ਰੇਨਰ ਨੇ ਅਧਿਆਪਕ ਨੇ ਉਹਨਾਂ ਦੇ ਲਈ ਉਹ ਉਪਲਬਧ ਕਰਵਾਏ ਜਾਂਦੇ ਨੇ ਉਹਨਾਂ ਵਿਦਿਆਰਥੀਆਂ ਦੀ ਡਿਵੈਲਪਮੈਂਟ ਦੇ ਲਈ ਅਜਿਹੇ ਵਿਦਿਆਰਥੀਆਂ ਦੇ ਲਈ ਟ੍ਰੇਨਰ ਨੇ ਜਿਹੜੇ ਅੰਨ੍ਹਿਆਂ ਨੂੰ ਬੋਲਿਆਂ ਨੂੰ ਉਹਨਾਂ ਨੂੰ ਸਿਖਾਉਣ ਦੇ ਲਈ ਉੱਦਾਂ ਦੇ ਹੀ ਅਧਿਆਪਕ ਉਪਲਬਧ ਕਰਵਾਏ ਜਾਂਦੇ ਨੇ ਅਤੇ ਅਜਿਹੇ ਮਾਮਲਿਆਂ ਦੇ ਵਿੱਚ ਜੋ ਸਕੂਲ ਨੇ ਜਾਂ ਟ੍ਰੇਨਰ ਨੇ ਉਹ ਵਧੀਆ ਤੋਂ ਵਧੀਆ ਫੈਕਲਟੀ ਉੱਥੇ ਹੋਣੀ ਚਾਹੀਦੀ ਆ ਜੋ ਕਿ ਜਿਹੜੇ ਅਪਾਹਜ ਬੱਚੇ ਨੇ ਜਾਂ ਅੰਨ੍ਹੇ ਬੋਲੇ ਬੱਚੇ ਨੇ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਚੰਗੀ ਤਰ੍ਹਾਂ ਹੋ ਸਕੇ